ਜਿਵੇਂ ਕਿ ਮੋਹਾਲੀ ਜ਼ਿਲ੍ਹੇ ਦੇ ਜਿਹੜੇ ਸਥਾਨਕ ਉਦਯੋਗ ਜਾਂ ਕਾਰੋਬਾਰ ਨੇ ਉਹਨਾਂ ਦੇ ਵਿੱਚ ਜਿਵੇਂ ਕਿ ਸਵਰਾਜ ਫੈਕਟਰੀ ਵੇਰਕਾ ਮਿਲਕ ਪਲਾਂਟ ਪਲਾਈਵੁੱਡ ਫੈਕਟਰੀਆਂ ਹੋ ਗਈਆਂ ਵੀ ਆਰ ਮੋਲ ਮੋਲ ਤਾਂ ਬਹੁਤ ਨੇ ਇੱਥੇ ਇਸ ਜ਼ਿਲ੍ਹੇ ਦੇ ਅੰਦਰ ਅਤੇ ਸਰਫ ਫੈਕਟਰੀਆਂ ਬਹੁਤ ਨੇ ਕੇਵਲ ਫੈਕਟਰੀਆਂ ਬਹੁਤ ਨੇ ਅਤੇ ਜਿੱਦਾਂ ਹੋਰ ਵੱਡੇ ਵੱਡੇ ਉਦਯੋਗ ਇਸ ਜ਼ਿਲ੍ਹੇ ਦੇ ਅੰਦਰ ਸਥਾਪਿਤ ਹਨ ਅਤੇ ਸਰਕਾਰੀ ਅਦਾਰੇ ਤਕਰੀਬਨ ਸਾਰੇ ਹੀ ਇਸ ਜ਼ਿਲ੍ਹੇ ਦੇ ਅੰਦਰ ਮੋਹਾਲੀ ਦੇ ਅੰਦਰ ਇੱਕ ਏਅਰਪੋਰਟ ਵੀ ਹੈ ਅਤੇ ਹੋਟਲ ਰੈਸਟੋਰੈਂਟ ਮੈਰਿਜ ਪੈਲੇਸ ਵਗੈਰਾ ਬਹੁਤ ਸਾਰੇ ਕਾਰੋਬਾਰ ਅਜਿਹੇ ਹਨ ਜਿਹੜੇ ਇਸ ਜ਼ਿਲ੍ਹੇ ਦੇ ਵਿੱਚ ਹਨ ਅਤੇ ਅੱਗੇ ਜਿਹੜੀ ਗੱਲ ਹੈ ਆਰਥਿਕਤਾ ਦੇ ਵਿੱਚ ਇਹ ਬਹੁਤ ਵੱਡਾ ਇਹਨਾਂ ਦਾ ਯੋਗਦਾਨ ਹੈ ਸਮੇਂ ਦੇ ਨਾਲ ਨਾਲ ਇਹ ਜਿਹੜੇ ਕਾਰੋਬਾਰ ਸੀਗੇ ਪਹਿਲਾਂ ਸ ਇਸ ਜ਼ਿਲ੍ਹੇ ਦੇ ਅੰਦਰ ਐਡਾ ਵਿਕਾਸ ਨਹੀਂ ਸੀ ਲੇਕਿਨ ਚੰਡੀਗੜ੍ਹ ਨੇੜੇ ਹੋਣ ਦੇ ਕਾਰਨ ਅਤੇ ਇਹਦਾ ਵਿਸਥਾਰ ਵੱਧਦਾ ਗਿਆ ਅਤੇ ਕਾਰੋਬਾਰ ਸਥਾਪਿਤ ਹੁੰਦੇ ਗਏ ਅਤੇ ਲੋਕਾਂ ਦੀ ਜਿਹੜੀ ਆਬਾਦੀ ਸੀ ਉਹ ਵੱਧਦੀ ਚਲੀ ਗਈ ਅਤੇ ਇਸ ਆਬਾਦੀ ਦੇ ਵਧਣ ਦੇ ਨਾਲ ਨਾਲ ਜਿਹੜਾ ਇੱਥੋਂ ਦਾ ਵਿਕਾਸ ਹੈ ਅਤੇ ਵਿਸਥਾਰ ਹੁੰਦਾ ਗਿਆ ਅਤੇ ਹੋ ਵੀ ਰਿਹਾ ਹੈ ਅਤੇ ਜਿਹੜੇ ਸਮੇਂ ਦੇ ਨਾਲ ਨਾਲ ਜਿਹੜੀਆਂ ਚੁਣੌਤੀਆਂ ਨੇ ਉਹ ਵੀ ਇਸ ਸ਼ਹਿਰ ਨੂੰ ਦੇ ਸਾਹਮਣੇ ਖੜ੍ਹੀਆਂ ਹੋਈਆਂ ਜਿਨ੍ਹਾਂ ਦੇ ਵਿੱਚ ਮੁੱਖ ਚੁਣੌਤੀਆਂ ਦੇ ਵਿੱਚ ਜਿੱਦਾਂ ਪਾਣੀ ਦੀ ਜਾਂ ਡਰੇਨ ਦੀ ਜਿਹੜੀ ਸਮੱਸਿਆ ਉਹ ਬਹੁਤ ਵੱਡੀ ਚੁਣੌਤੀ ਇਹਨਾਂ ਨੂੰ ਜਦੋਂ ਜ਼ਿਆਦਾ ਮੀਂਹ ਪੈ ਜਾਂਦਾ ਤਾਂ ਜਿਹੜਾ ਇਹ ਡਰੇਨ ਸਿਸਟਮ ਹੈ ਇੱਥੇ ਦਾ ਉਹ ਐਡਾ ਸਾਰਥਕ ਨਹੀਂ ਹੈ ਕਿ ਉਸ ਪਾਣੀ ਸੰਭਾਲ ਸਕੇ ਅਤੇ ਉਸ ਪਾਣੀ ਨੂੰ ਜਦੋਂ ਨਹੀਂ ਸੰਭਾਲ ਪਾਉਂਦਾ ਤਾਂ ਇਹ ਜਿਹੜਾ ਪਾਣੀ ਹੈ ਇਹਨਾਂ ਉਦਯੋਗਾਂ 'ਚ ਇਹਨਾਂ ਫੈਕਟਰੀਆਂ 'ਚ ਅਤੇ ਲੋਕਾਂ ਦੇ ਘਰਾਂ ਤੱਕ ਵੀ ਮਾਰ ਕਰ ਦਿੰਦਾ ਇਹ ਜੋ ਜੋ ਵੱਡੀ ਚੁਣੌਤੀ ਹੈ ਇਸ ਜ਼ਿਲ੍ਹੇ ਦੇ ਲਈ ਅਤੇ ਜਿਹਦਾ ਸਾਰਥਕ ਪ੍ਰਬੰਧ ਸਰਕਾਰਾਂ ਨੂੰ ਜ਼ਰੂਰ ਕਰਨਾ ਚਾਹੀਦਾ ਹੈ